ਕੁਝ ਸਥਾਨ ਸਿੱਖਿਆ ਸਿੱਖਣ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਕਈ ਸਥਾਨ ਐਵੇਂ ਦੇ ਹਨ ਜਿੱਥੇ ਸਿੱਖਿਆ ਦੇ ਬਾਰੇ ਦੱਸਿਆ ਜਾਂਦਾ ਐ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਦੇ ਵੀ ਉੱਪਰ ਕਈ ਤਰ੍ਹਾਂ ਦੇ ਮਤਲਬ ਕਿ ਕਲਾਸਾਂ ਵਗੈਰਾ ਲੱਗਦੀਆਂ ਹਨ ਉਹ ਸਾਨੂੰ ਗਵਾਉਣੀਆਂ ਨਹੀਂ ਚਾਹੀਦੀਆਂ ਉਹਨਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਅਤੇ ਸਾਡੇ ਵਿੱਦਿਅਕ ਜ਼ਿਲ੍ਹੇ ਦੇ ਵਿੱਚ ਸਮੁੱਚੇ ਵਿਕਾਸ ਨੇ ਕਰਿਆ ਯੋਗਦਾਨ ਪਾਇਆ ਸਿੱਖਿਆ ਦੇ ਵਿੱਚ ਜਿਵੇਂ ਕਿ ਸਾਡੇ ਇੱਕ ਮੰਤਰੀ ਨੇ ਉਹਨਾਂ ਦੇ ਇਸ ਵਾਰ ਸਕੂਲਾਂ ਦੇ ਵਿੱਚ ਜਿਹੜੀਆਂ ਬੁੱਕਸ ਵਗੈਰਾ ਲੇਟ ਆਉਂਦੀ ਤੀਆ ਕਿਤਾਬਾਂ ਕਾਪੀਆਂ ਉਹ ਬੱਚਿਆਂ ਨੂੰ ਐਂਤਕੀ ਕਲਾਸਾਂ ਲੱਗਣ ਤੋਂ ਪਹਿਲਾਂ ਹੀ ਦ ਪਹੁੰਚਾ ਤੀਆਂ ਅਤੇ ਬੱਚੇ ਉਹਨਾਂ ਦਾ ਪੂਰਾ ਲਾਹਾ ਲੈ ਰਹੇ ਹੈ ਅਤੇ ਆਪਣੀ ਪੜ੍ਹਾਈ ਪ੍ਰੋਪਰ ਕਰ ਰਹੇ ਨੇ ਅਤੇ ਪ੍ਰਵੇਸ਼ ਕੇਂਦਰ ਸਾਡੇ ਇੱਧਰ ਕੁਰਾਲੀ ਵਿੱਚ ਕੋਚਿੰਗ ਕਲਾਸਾਂ ਲੱਗਦੀਆਂ ਹੈ ਅਤੇ ਉਹਨਾਂ ਦੇ ਵਿੱਚ ਵੀ ਅੱਛੀ ਕੋਚਿੰਗ ਦਈ ਜਾਂਦੀ ਹੈ ਸਰਕਾਰੀ ਸਕੂਲਾਂ ਦਾ ਹਾਲ ਸਰਕਾਰੀ ਸਕੂਲਾਂ ਦਾ ਹਾਲ ਪਹਿਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਠੀਕ ਹੈ ਪਹਿਲਾਂ ਪ੍ਰਾਈਮਰੀ ਸਕੂਲਾਂ 'ਚ ਕੋਈ ਟੀਚਰ ਨਹੀਂ ਤੇ ਹੁੰਦੇ ਇੱਕ ਟੀਚਰ ਪੰਜਵੀਂ ਤੱਕ ਪੜ੍ਹਾਉਂਦੇ ਤੇ ਪਰ ਹੁਣ ਇਸ ਤਰ੍ਹਾਂ ਨਹੀਂ ਹੈਗਾ ਹੁਣ ਸਾਰੀਆਂ ਕਲਾਸਾਂ ਦੇ ਵਿੱਚ ਪਰੋਪਰ ਬੱਚੇ ਹੁੰਦੇ ਅਤੇ ਪਰੋਪਰ ਹੀ ਟੀਚਰ ਹੁੰਦੇ ਅਤੇ ਸਰਕਾਰੀ ਸਕੂਲਾਂ ਦਾ ਵੀ ਹੁਣ ਬਹੁਤ ਹੀ ਜ਼ਿਆਦਾ ਸੁਧਾਰ ਹੈ ਅਤੇ ਆਸ ਕਰਦੇ ਹਾਂ ਵੀ ਇਹਦੇ ਨਾਲੋਂ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਵਧੀਆ ਹੋਵੇਗਾ ਅਤੇ ਬੱਚਿਆਂ ਨੂੰ ਦੂਰ ਜਾਣ ਦੀ ਲੋੜ ਨੀ ਪਵੇਗੀ ਅਤੇ ਇੱਥੇ ਹੀ ਆਪਣੀ ਸਿੱਖਿਆ ਪੂਰੀ ਕਰੂਗੇ